ਸਾਡੇ ਖੇਤਰ ਵਿੱਚ ਹਾਕੀ ਫੁੱਟਬਾਲ ਕ੍ਰਿਕਟ ਬੈਡਮਿੰਟਨ ਅਤੇ ਆਪਣਾ ਬਾਸਕਿਟਵਾਲ ਵੋਲੀਬੋਲ ਅਤੇ ਹੋਕੀ ਆਦਿ ਇਹ ਖੇਡਾਂ ਖੇਡੀਆਂ ਜਾਂਦੀਆਂ ਹਨ ਸਾਡੇ ਖੇਤਰ ਵਿੱਚ ਅਤੇ ਹੋਰ ਖੇਤਰਾਂ ਵਿੱਚ ਕੁਝ ਜ਼ਿਆਦਾ ਫਰਕ ਨਹੀਂ ਹੈ ਪਰ ਜੋ ਸਾਡੇ ਖੇਤਰ ਦੀ ਸਰਕਾਰ ਹੈ ਉਹ ਸਾਡੇ ਖੇਡਾਂ ਵਿੱਚ ਬਹੁਤ ਰੁਚੀ ਦਿਖਾਉਂਦੀ ਹੈ ਅਤੇ ਉਹ ਨੌਜਵਾਨਾਂ ਨੂੰ ਉਤਸ਼ਾਹਿਤ ਕਰਦੀ ਹੈ ਕਿ ਸਾਨੂੰ ਖੇਡਾਂ ਵਿੱਚ ਭਾਗ ਲੈਣਾ ਚਾਹੀਦਾ ਹੈ ਅਤੇ ਸਰਕਾਰ ਵੱਖ ਵੱਖ ਥਾਵਾਂ ਦੇ ਵੱਖ ਵੱਖ ਜਗ੍ਹਾਵਾਂ 'ਤੇ ਟੂਰਨਾਮੈਂਟ ਕਰਵਾਉਂਦੇ ਰਹਿੰਦੇ ਹਨ ਜਿਸ ਕਰਕੇ ਨੌਜਵਾਨ ਨੇ ਜਿਹੜੇ ਉਹ ਖੇਡਾਂ ਵੱਲ ਜ਼ਿਆਦਾ ਅਟਰੈਕਟ ਹੁੰਦੇ ਹਨ ਅਤੇ ਜਿਸ ਕਾਰਨ ਉਹਨਾਂ ਦੀ ਖੇਡਾਂ ਵਿੱਚ ਰੁਚੀ ਬਣੀ ਜਾਂਦੀ ਹੈ ਰੁਚੀ ਬਣੀ ਰਹਿੰਦੀ ਹੈ ਅਤੇ ਸਰਕਾਰ ਵੀ ਇਸ ਵਿੱਚ ਕੋਈ ਕਮੀ ਨਹੀਂ ਛੱਡਦੀ ਅਤੇ ਉਹ ਖੇਡਾਂ ਪ੍ਰਤੀ ਬਹੁਤ ਉਤਸ਼ਾਹਿਤ ਹੋ ਕੇ ਕੰਮ ਕਰਦੇ ਹਨ ਅਤੇ ਨੌਜਵਾਨ ਵੀ ਉਸ ਵਿੱਚ ਭਾਗ ਲੈਂਦੇ ਹਨ ਅਤੇ ਜਿਸ ਕਰਕੇ ਹੀ ਨੌਜਵਾਨ ਨੇ ਜਿਹੜੇ ਉਹ ਖੇਡਾਂ ਵੱਲ ਜ਼ਿਆਦਾ ਆਕਰਸ਼ਿਤ ਹੁੰਦੇ ਹਨ